ਮੈਨੂੰ ਨਾ ਰੀਡਿੰਗ ਕਰਨ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੈਨੂੰ ਜਿਹੜੀ ਰੀਡਿੰਗ ਬੁੱਕ ਰੀਡਿੰਗ ਜਿਹੜੀ ਹੈਗੀ ਅੱਛੀ ਲੱਗਦੀ ਹੈ ਬਚਪਨ ਦੇ ਵਿੱਚ ਹੀ ਮੇਰੇ ਪਾਪਾ ਜਿਹੜੇ ਹੈਗੇ ਹੈ ਉਹ ਬਹੁਤ ਧਾਰਮਿਕ ਕਿਤਾਬਾਂ ਜਿਹੜੀਆਂ ਨੇ ਘਰੇ ਲੈ ਕੇ ਆਉਂਦੇ ਹੁੰਦੇ ਸੀਗੇ ਉਹਨਾਂ ਦਾ ਵੀ ਸਿੱਖੀ ਵੱਲ ਕਾਫੀ ਮਤਲਬ ਜਿਹੜਾ ਹੈਗਾ ਝੁਕਾਅ ਹੈਗਾ ਅਤੇ ਉਹ ਕਾਫੀ ਰਲੀਜੀਅਸ ਬੁੱਕਸ ਜਿਹੜੀਆਂ ਲੈ ਕੇ ਆਉਂਦੇ ਹੁੰਦੇ ਸੀਗੇ ਘਰ ਅਤੇ ਅਸੀਂ ਛੋਟੀਆਂ ਛੋਟੀਆਂ ਬੁੱਕਸ ਉਦੋਂ ਮੈਂ ਪੜ੍ਹਦੀ ਹੁੰਦੀ ਸੀ ਥੋੜ੍ਹੀਆਂ ਥੋੜ੍ਹੀਆਂ ਅਤੇ ਮੈਨੂੰ ਵਧੀਆ ਲੱਗਦੀਆਂ ਸੀ ਜਦੋਂ ਵੀ ਛੁੱਟੀ ਵਾਲੇ ਦਿਨ ਬੈਠ ਕੇ ਨਾ ਕਾਫੀ ਕਾਫੀ ਦੇਰ ਬੁੱਕ ਪੜ੍ਹੀ ਜਾਣਾ ਅਤੇ ਫਿਰ ਮੈਨੂੰ ਨਾ ਥੋੜ੍ਹਾ ਚਸਕਾ ਵੀ ਪੈ ਗਿਆ ਵੀ ਜਦੋਂ ਇੱਕ ਬੁੱਕ ਸਟਾਰਟ ਕਰਤੀ ਵੀ ਇਹਨੂੰ ਹੁਣ ਖਤਮ ਹੀ ਕਰਨਾ ਹੈ ਅਤੇ ਉਹ ਵੇਖਦੇ ਹੋਏ ਨਾ ਮੈਨੂੰ ਲਾਈਬ੍ਰੇਰੀ ਵੀ ਬਹੁਤ ਵਧੀਆ ਲੱਗਦੀ ਆ ਵੈਸੇ ਸਾਡੇ ਕੋਲਜ ਦੇ ਵਿੱਚ ਵੀ ਲਾਈਬ੍ਰੇਰੀ ਬਹੁਤ ਵੱਡੀ ਹੈਗੀ ਆ ਅਤੇ ਮੈਂ ਘਰ ਦੇ ਵਿੱਚ ਵੀ ਇੱਕ ਛੋਟੀ ਜਿਹੀ ਲਾਈਬ੍ਰੇਰੀ ਬਣਾਈ ਹੋਈ ਹੈ ਜਿਹਦੇ ਵਿੱਚ ਮੈਂ ਕੁਛ ਸਟੋਰੀ ਬੁੱਕਸ ਰੱਖੀਆਂ ਹੋਈਆਂ ਨੇ ਕੁਛ ਧਾਰਮਿਕ ਕਿਤਾਬਾਂ ਵੀ ਨੇ ਜਿਹੜੀਆਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਹੈ ਸਟੋਰੀ ਬੁੱਕਸ ਤੋਂ ਇਲਾਵਾ ਮੈਂ ਕੁਛ ਇੰਗਲਿਸ਼ ਦੇ ਨੋਵਲਸ ਵੀ ਹੈਗੇ ਹਾਂ ਮੇਰੇ ਕੋਲ ਜਿਹੜੇ ਮੈਂ ਰੱਖੇ ਹੋਏ ਹਾਂ ਅਤੇ ਮੈਂ ਵਿਹਲੇ ਟਾਈਮ ਦੇ ਵਿੱਚ ਉਹਨੂੰ ਪੜ੍ਹਦੀ ਹਾਂ ਅਤੇ ਸੁਪਨਿਆਂ ਦੀ ਲਾਈਬ੍ਰੇਰੀ ਦੀ ਜੇ ਗੱਲ ਕਰੀਏ ਤਾਂ ਮੇਰੇ ਸੁਪਨੇ ਦੀ ਲਾਈਬ੍ਰੇਰੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਵੀ ਘਰ ਦੇ ਵਿੱਚ ਇੱਕ ਪ੍ਰੋਪਰ ਰੂਮ ਹੋਵੇ ਜਿਹਦੇ ਵਿੱਚ ਲਾਈਬ੍ਰੇਰੀ ਹੋਵੇ ਔਰ ਕੁਛ ਬਹੁਤ ਸੋਹਣੀਆਂ ਜਿਹੀਆਂ ਕੁਰਸੀਆਂ ਉੱਥੇ ਹੋਣ ਲਾਈਬ੍ਰੇਰੀ ਦੇ ਵਿੱਚ